ਹੈਲੋ ਸਤਿ ਸ਼੍ਰੀ ਅਕਾਲ ਜੀ ਜੈਨ ਢਾਬੇ ਤੋਂ ਗੱਲ ਕਰਦੇ ਹੋਂ ਸ਼ਾਮ ਨੂੰ ਮੈਂ ਆਪਣੇ ਦੋਸਤਾਂ ਦੇ ਨਾਲ ਤੁਹਾਡੇ ਢਾਬੇ 'ਤੇ ਪਹੁੰਚਣਾ ਹੈ ਅਤੇ ਮੈਨੂੰ ਕੁਝ ਪ੍ਰਾਈਵੇਟ ਟੇਬਲ ਜਾਂ ਜਾਂ ਕੋਈ ਪ੍ਰਾਈਵੇਟ ਕੈਬਿਨ ਮਿਲ ਸਕਦਾ ਹੈ ਜਿੱਥੇ ਮੈਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਕੋਈ ਪਰਸਨਲ ਗੱਲ ਕਰ ਸਕਾਂ ਅਤੇ ਉੱਥੇ ਬੈਠ ਕੇ ਮੈਂ ਉਨ੍ਹਾਂ ਦੇ ਨਾਲ ਡਿਨਰ ਜਾਂ ਕੁਝ ਸਨੈਕਸ ਦੀ ਵਰਤੋਂ ਨਾਲ ਉਹਨਾਂ ਨਾਲ ਮੈਂ ਕੁਝ ਗੱਲਾਂ ਬਾਤਾਂ ਅਤੇ ਨਾਲ ਕੁਝ ਖਾ ਪੀ ਸਕਾਂ ਧੰਨਵਾਦ